ਇਹ ਅਕਸਰ ਨਿਰਭਰ ਕਰਦਾ ਹੈ ਕਿ ਅੱਗੋਂ ਬੋਲਣ ਵਾਲੇ ਦੀ ਭਾਸ਼ਾ ਕਿਹੜੀ ਹੈ ਜੇ ਤਾਂ ਅੰਗਰੇਜ਼ੀ ਹੋਵੇ ਜਿਹੜੀ ਕਿ ਭਾਰਤ ਦੇ ਵਿੱਚ ਬਹੁਤੇ ਲੋਕ ਜਾਣਦੇ ਹਨ ਅਤੇ ਪੰਜਾਬ ਅੰਦਰ ਵੀ ਬਹੁਤੇ ਲੋਕਾਂ ਜਾਣਦੇ ਹਨ ਤਾਂ ਤਾਂ ਸੌਖਾ ਹੋ ਜਾਂਦਾ ਬੰਦਾ ਅਗਾਂਹ ਤੋਂ ਰਲੀ ਮਿਲੀ ਅੰਗਰੇਜ਼ੀ ਪੰਜਾਬੀ ਯਾਂ ਸ਼ੁੱਧ ਅੰਗਰੇਜ਼ੀ ਵਿੱਚ ਗੱਲ ਕਰ ਲੈਂਦਾ ਪਰ ਜੇ ਜਾਂ ਤਾਂ ਹਿੰਦੀ ਹੋਵੇ ਉਰਦੂ ਹੋਵੇ ਤਾਂ ਵੀ ਕੁਝ ਹੱਦ ਤੱਕ ਸੌਖਾ ਹੋ ਜਾਂਦਾ ਕਿਉਂਕਿ ਹਿੰਦੀ ਔਰ ਉਰਦੂ ਦੇ ਬਹੁਤੇ ਸ਼ਬਦ ਪੰਜਾਬੀ ਨਾਲ ਮੇਲ ਖਾਂਦੇ ਨੇ ਅਤੇ ਹਿੰਦੀ ਬੋਲਣ ਵਾਲੇ ਅਕਸਰ ਪੰਜਾਬੀ ਸਮਝ ਲੈਂਦੇ ਨੇ ਜੇ ਬੋਲ ਨਹੀਂ ਸਕਦੇ ਤਾਂ ਸਮਝ ਜ਼ਰੂਰ ਲੈਂਦੇ ਨੇ ਅਤੇ ਪੰਜਾਬੀ ਵੀ ਜੇ ਹਿੰਦੀ ਬੋਲ ਨਹੀਂ ਸਕਦੇ ਤਾਂ ਸਮਝ ਜ਼ਰੂਰ ਲੈਂਦੇ ਨੇ ਤਾਂ ਗੱਲਬਾਤ ਕਰਨੀ ਸੌਖੀ ਹੋ ਜਾਂਦੀ ਪੰਜਾਬੀ ਵਾਲੇ ਪੰਜਾਬੀ ਬੋਲ ਸਕਦੇ ਅਤੇ ਹਿੰਦੀ ਵਾਲੇ ਸੁਣਕੇ ਸਮਝ ਲੈਂਦੇ ਨੇ ਉਰਦੂ ਨਾਲ ਵੀ ਬਿਲਕੁਲ ਆਹੀ ਗੱਲ ਪਰ ਜੇ ਹੋਰ ਕੋਈ ਭਾਸ਼ਾ ਹੈ ਗੁਜਰਾਤੀ ਮਰਾਠੀ ਜਾਂ ਫਾਰਸੀ ਅਰਬੀ ਜਾਂ ਕੋਈ ਫਰਾਂਸੀ ਸੀ ਉਧਰ ਵੈਸ ਦੀ ਤਾਂ ਅਕਸਰ ਪੰਜਾਬ ਦੇ ਅੰਦਰ ਜ਼ਿਆਦਾ ਗੂਗਲ ਟਰਾਂਸਲੇਟ ਵਰਤਿਆ ਜਾ ਸਕਦਾ ਜਾਂ ਇਸ਼ਾਰਿਆਂ ਨਾਲ ਗੱਲ ਸਮਝਾਈ ਜਾ ਸਕਦੀ ਆ ਜਾਂ ਫਿਰ ਨੇੜੇ ਦੇ ਸਾਂਝ ਕੇਂਦਰ ਆ ਹੈਲਪਲਾਈਨ ਕੇਂਦਰ ਦੇ ਅੰਦਰ ਉਹਨਾਂ ਨੂੰ ਉਹਨਾਂ ਨਾਲ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਬਾਕੀ ਬਹੁਤੀ ਗੱਲ ਇਸ਼ਾਰਿਆਂ ਨਾਲ ਅਕਸਰ ਹੋ ਜਾਂਦੀ ਹੈ ਤਾਂ ਜ਼ਿਆਦਾਤਰ ਇੱਦਾਂ ਹੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕ ਆਪਣੀ ਭਾਸ਼ਾ ਦੀ ਵਰਤੋਂ ਦੂਜਿਆਂ ਨਾਲ ਇੱਦਾਂ ਹੀ ਕਰਦੇ ਹਨ ਅਤੇ ਜਾਂ ਫਿਰ ਪੰਜਾਬ ਦੇ ਅੰਦਰ ਜਿਹੜੀ ਵੀ ਅਗਰ ਕੋਈ ਬਾਹਰੋਂ ਟੂਰਿਸਟ ਆਉਂਦੇ ਹਾਂ ਉਹ ਅਕਸਰ ਸਿੱਖ ਕੇ ਆਉਂਦੇ ਆ ਕੁਝ ਸ਼ਬਦਾਂ ਜਿਹੜੇ ਲੋੜ ਲਈ ਜ਼ਰੂਰੀ ਹੋਣ ਵਿਚ ਰਹਿਣ ਲਈ ਪੰਜਾਬ ਅੰਦਰ ਤਾਂ ਬਿਲਕੁਲ ਸੌਖੀ ਪੰਜਾਬੀ ਬੋਲ ਕੇ ਇਸ਼ਾਰਿਆਂ ਦੇ ਨਾਲ ਇਸ਼ਾਰਿਆਂ ਨੂੰ ਵਰਤ ਕੇ ਤੇ ਇੱਕ ਦੋ ਭਾਸ਼ਾਵਾਂ ਦੇ ਹੋਰ ਸ਼ਬਦ ਨਾਲ ਜੋੜ ਕੇ ਰਲਾ ਕੇ ਗੱਲਬਾਤ ਕੀਤੀ ਜਾ ਸਕਦੀ ਹੈ